ਪੰਜਾਬ 'ਚ ਵੈਸੇ ਤਾਂ ਦੇਖਣ ਵਾਲੇ ਬਹੁਤ ਸਥਾਨ ਹਨ ਉਹਨਾਂ ਵਿੱਚੋਂ ਜਿਹੜੇ ਮਸ਼ਹੂਰ ਹੈ ਰਣਜੀਤ ਸਿੰਘ ਵਾਰ ਮੈਮੋਰੀਅਲ ਗੋਲਡਨ ਟੈਂਪਲ ਦੁਰਗਿਆਣਾ ਮੰਦਰ ਜਲਿਆਂਵਾਲਾ ਬਾਗ ਵਾਹਗਾ ਬਾਰਡਰ ਦੇਵੀ ਤਲਾਬ ਰੋਜ਼ ਗਾਰਡਨ ਰੋਕ ਗਾਰਡਨ ਸ਼ਹੀਦੀ ਸਮਾਰਕ ਬਾਰਾਦਰੀ ਗਾਰਡਨ ਮੋਤੀ ਮਹਿਲ ਮਾਲ ਰੋਡ ਕੈਨਟ ਏਰੀਆ ਚੌੜੀ ਸੜਕ